ਹੈਲੋ ਸਤਿ ਸ਼੍ਰੀ ਅਕਾਲ ਆਂਟੀ ਜੀ ਹਾਂਜੀ ਹਾਂਜੀ ਅੱਛਾ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਬਹੁਤ ਬਹੁਤ ਵੈਲਕਮ ਹੈ ਜੀ ਅੱਛਾ ਜੀ ਹਾਂਜੀ ਹਾਂਜੀ ਜ਼ਰੂਰ ਆਂਟੀ ਜੀ ਤੁਸੀਂ ਕਿੱਥੇ ਜ਼ਿਆਦਾ ਜੋਬ ਕਿੱਥੇ ਪ੍ਰੈਫਰ ਕਰਦੇ ਹੋ ਅੱਛਾ ਜੀ ਦੇਖੋ ਜੀ ਜਿਵੇਂ ਤੁਹਾਨੂੰ ਪਤਾ ਕਿ ਆਪਾਂ ਗਲੀ ਨੰਬਰ ਪੰਜ ਵਿੱਚ ਰਹਿੰਦੇ ਹਾਂ ਇਥੋਂ ਸਿੱਧਾ ਬਾਹਰ ਨਿਕਲਦੇ ਹੀ ਜਿਹੜੀ ਸ਼ਹੀਦਾਂ ਸਾਹਿਬ ਰੋਡ ਆਉਂਦੀ ਹੈ ਜਿੱਥੇ ਅੱਗੇ ਜਾ ਕੇ ਸੁਲਤਾਨਵਿੰਡ ਰੋਡ ਤੋਂ ਮਿਲਦੀ ਹੈ ਇੱਥੇ ਸਾਨੂੰ ਦਸ ਦਸ ਪੰਦਰਾਂ ਪੰਦਰਾਂ ਰੁਪਏ ਵਿੱਚ ਈ ਰਿਕਸ਼ੇ ਆਮ ਮਿਲ ਜਾਂਦੇ ਹਨ ਗਲੀ ਬਾਹਰ ਨਿਕਲਦੇ ਸਾਨੂੰ ਈ ਰਿਕਸ਼ਾ ਜਾਂ ਆਟੋ ਮਿਲ ਜਾਂਦਾ ਹੈ ਜਿਸ ਨਾਲ ਆਪਾਂ ਸਫ਼ਰ ਕਰਕੇ ਬੱਸ ਸਟੈਂਡ ਤੱਕ ਪਹੁੰਚ ਸਕਦੇ ਹਾਂ ਅਤੇ ਬੱਸ ਸਟੈਂਡ ਤੋਂ ਹਰ ਪੰਦਰਾਂ ਵੀਹ ਮਿੰਟ ਦੀ ਗੈਪ ਦੇ ਵਿੱਚ ਸਾਨੂੰ ਇੱਕ ਬਸ ਮਿਲ ਜਾਂਦੀ ਹੈ ਜਲੰਧਰ ਵਾਸਤੇ ਪਰ ਜੇਕਰ ਤੁਸੀਂ ਜੋਬ ਲਈ ਰੋਜ਼ ਜਾਣਾ ਹੈ ਤਾਂ ਤੁਸੀਂ ਪਾਸ ਵੀ ਬਣਾ ਸਕਦੇ ਹੋ ਹਾਂਜੀ ਹਾਂਜੀ ਪਾਸ ਵੀ ਬਣ ਜਾਂਦੇ ਆ ਜਿਹਦੇ ਨਾਲ ਤੁਹਾਨੂੰ ਰੋਜ਼ ਰੋਜ਼ ਦੀ ਟਿਕਟ ਖਰੀਦਣ ਦੀ ਜਿਹੜੀ ਦਿੱਕਤ ਹੈ ਉਹਦੇ ਤੋਂ ਛੁਟਕਾਰਾ ਮਿਲ ਜਾਵੇਗਾ ਹਾਂਜੀ ਹਾਂਜੀ ਰੇਲਵੇ ਸਟੇਸ਼ਨ ਥੋੜ੍ਹਾ ਜਿਹਾ ਦੂਰ ਹੈ ਬੱਸ ਸਟੈਂਡ ਤੋਂ ਜਿਵੇਂ ਕਿ ਬੱਸ ਸਟੈਂਡ ਇੱਥੋਂ ਸਿਰਫ ਡੇਢ ਦੋ ਕਿਲੋਮੀਟਰ ਦੀ ਦੂਰੀ 'ਤੇ ਹੈ ਪਰ ਜਿਹੜਾ ਰੇਲਵੇ ਸਟੇਸ਼ਨ ਹੈ ਉਹ ਚਾਰ ਪੰਜ ਕਿਲੋਮੀਟਰ ਦੀ ਦੂਰੀ 'ਤੇ ਹੈ ਪਰ ਉਹਦੇ ਲਈ ਵੀ ਜਿਹੜਾ ਆਟੋ ਸਾਨੂੰ ਗਲੀ ਬਾਹਰੋਂ ਹੀ ਮਿਲ ਜਾਂਦਾ

ਦੇਖ ਦੇਖੋ ਜੀ ਤੁਹਾਨੂੰ ਜਿਵੇਂ ਪਤਾ ਕਿ ਅੰਮ੍ਰਿਤਸਰ ਵਿੱਚ ਬਹੁਤ ਟੂਰਿਸਟ ਆਉਣ ਲੱਗ ਗਿਆ ਅੱਜ ਕੱਲ੍ਹ ਜਿਹਦੇ ਕਰਕੇ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨਾਂ 'ਤੇ ਬਹੁਤ ਜ਼ਿਆਦਾ ਭੀੜ ਰਹਿੰਦੀ ਆ ਜੇਕਰ ਮੇਰੀ ਸਲਾਹ ਮੰਨੋਗੇ ਤਾਂ ਪਹਿਲੇ ਹੀ ਟਿਕਟ ਬੁੱਕ ਕਰਕੇ ਔਨਲਾਈਨ ਮਾਧਿਅਮ ਰਾਹੀਂ ਤੁਹਾਨੂੰ ਉੱਥੇ ਜਾਣਾ ਚਾਹੀਦਾ ਹੈ ਤਾਂ ਕਿ ਜਿਹੜੀ ਧੱਕਾ ਮੁੱਕੀ ਆ ਉਹਦੇ ਤੋਂ ਛੁਟਕਾਰਾ ਮਿਲ ਸਕੇ ਅਤੇ ਬੜਾ ਆਰਾਮ ਦਾ ਇੱਕ ਸਫ਼ਰ ਦਾ ਆਨੰਦ ਤੁਸੀਂ ਮਾਣ ਸਕੋ ਹਾਂਜੀ ਹਾਂਜੀ ਹਾਂਜੀ ਹਾਂਜੀ ਇੱਥੇ ਆਮ ਜਿਹੜੇ ਈ ਰਿਕਸ਼ਾ ਹੈਗੇ ਨੇ ਉਹ ਚੱਲਦੇ ਨੇ ਜਿਹੜੇ ਸਾਨੂੰ ਆਹ ਛੋਟੀ ਮੋਟੀ ਜਗ੍ਹਾ 'ਤੇ ਆਮ ਲੈ ਕੇ ਜਾ ਸਕਦੇ ਨੇ ਕਿਸੇ ਦਿੱਕਤ ਦੀ ਲੋੜ ਨਹੀਂ ਹੈਗੀ ਹਾਂਜੀ ਹਾਂਜੀ ਬੜੇ ਆਰਾਮ ਨਾਲ ਚਲੇ ਜਾਂਦੇ ਨੇ ਹਾਂਜੀ ਹਾਂਜੀ ਉਹ ਰੇਲਵੇ ਸਟੇਸ਼ਨ ਤੋਂ ਬਿਲਕੁਲ ਅੱਧਾ ਪੌਣਾ ਕਿਲੋਮੀਟਰ ਦੀ ਦੂਰੀ 'ਤੇ ਹੈ ਹਾਂਜੀ ਹਾਂਜੀ ਹਾਂਜੀ ਉਹ ਵੀ ਬੁੱਕ ਹੋ ਜਾਂਦੀ ਹੈ ਸਾਡੀ ਲੋਕੈਲਿਟੀ ਕਾਫੀ ਮਸ਼ਹੂਰ ਹੈ ਇੱਥੇ ਬੜੇ ਆਰਾਮ ਦੇ ਨਾਲ ਬੜੇ ਵਧੀਆ ਤਰੀਕੇ ਦੇ ਨਾਲ ਕੈਬ ਡਰਾਈਵਰਸ ਪਹੁੰਚ ਜਾਂਦੇ ਨੇ ਜੇ ਤੁਸੀਂ ਕੈਬ ਬੁੱਕ ਕਰਨੀ ਹੈ ਤਾਂ ਉਹ ਤਾਂ ਬਹੁਤ ਵਧੀਆ ਹੋ ਜਾਏਗਾ ਹਾਂਜੀ ਹਾਂਜੀ ਠੀਕ ਹੈ ਜੀ ਓਕੇ